ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਬੋਲ ਰਹੇ ਜੀ ਅਸੀਂ ਦੋ ਮਹੀਨੇ ਪਹਿਲਾਂ ਤੁਹਾਡੇ ਤੋਂ ਏ ਸੀ ਲਿਆ ਸੀ ਹਿਟੈਚੀ ਕੋਪਨੀ ਦਾ ਡੇਢ ਟਨ ਜੋ ਕਿ ਬਹੁਤ ਵਧੀਆ ਮਿਲਿਆ ਇੱਕ ਤਾਂ ਉਹਦਾ ਰੇਟ ਬਹੁਤ ਵਧੀਆ ਮਿਲਿਆ ਬਜ਼ਾਰ ਨਾਲੋਂ ਕਾਫੀ ਸਸਤਾ ਸੀ ਅਤੇ ਪੈਕਿੰਗ ਵੀ ਸਾਨੂੰ ਬਹੁਤ ਵਧੀਆ ਲੱਗੀ ਬਿਜਲੀ ਬਹੁਤ ਘੱਟ ਖਾਂਦਾ ਹੈ ਅਤੇ ਠੰਡਾ ਵੀ ਬਹੁਤ ਜ਼ਿਆਦਾ ਕਰਦਾ ਹੈ ਦਸ ਮਿੰਟ ਦੇ ਵਿੱਚ ਕਮਰਾ ਠੰਡਾ ਕਰ ਦਿੰਦਾ ਹੈ ਅਤੇ ਬਹੁਤ ਵਧੀਆ ਸਾਨੂੰ ਸਰਵਿਸ ਲੱਗੀ ਅਤੇ ਬਾਕੀ ਆਪ ਜੀ ਦਾ ਬਹੁਤ ਧੰਨਵਾਦ